ਜਦੋਂ ਮੈਂ ਦਸਵੀਂ ਜਮਾਤ ਵਿੱਚ ਸੀ ਤਾਂ ਮੈਨੇ ਅਪਣੀ ਪਹਿਲੀ ਡਰੋਇੰਗ ਬਣਾਈ ਸੀ ਪਹਿਲਾਂ ਤਾਂ ਮੈਨੂੰ ਡਰੋਇੰਗ ਵਿੱਚ ਕੋਈ ਇਨਟਰੱਸਟ ਨਹੀਂ ਹੁੰਦਾ ਸੀ ਪਰ ਮੈਂ ਜਦੋਂ ਫੋਨ ਵਿੱਚ ਡਰੋਇੰਗ ਦੀ ਵੀਡੀਓਸ ਦੇਖਦੀ ਰਹਿੰਦੀ ਸੀ ਤਾਂ ਮੈਨੂੰ ਇਨਟਰੱਸਟ ਪੈਦਾ ਹੋ ਗਿਆ ਅਤੇ ਫਿਰ ਮੈਨੇ ਅਪਣੀ ਡਰੋਇੰਗ ਬਣਾਉਣੀ ਸ਼ੁਰੂ ਕੀਤੀ ਤਾਂ ਮੈਨੇ ਦੇਖਿਆ ਕਿ ਮੇਰੀ ਡਰੋਇੰਗ ਵਧੀਆ ਹੈ ਕਿ ਮੈਨੇ ਆਪਣੇ ਇਸ ਇਨਟਰੱਸਟ ਨੂੰ ਛੱਡਿਆ ਨਹੀਂ ਮੈਨੇ ਇਸ ਵਿੱਚ ਇਨਟਰੱਸਟ ਬਣਾਈ ਰੱਖਿਆ ਜਦੋਂ ਮੈਂ ਆਪਣੀ ਪਲੱਸ ਟੂ ਕੰਪਲੀਟ ਕੀਤੀ ਤਾਂ ਮੈਨੇ ਬੀ ਏ ਵਿੱਚ ਵੀ ਡਰੋਇੰਗ ਦਾ ਹੀ ਸਬਜੈਕਟ ਚੁਣਿਆ ਕਿਉਂਕਿ ਮੈਨੂੰ ਇਸ ਵਿੱਚ ਇਨਟਰੱਸਟ ਆ ਗਿਆ ਸੀ ਮੈਨੇ ਆਪਣੀ ਡਰੋਇੰਗ ਨੂੰ ਹੋਰ ਵੀ ਜ਼ਿਆਦਾ ਵਧੀਆ ਕੀਤਾ ਹੋਰ ਵੀ ਜ਼ਿਆਦਾ ਇਸ ਵਿੱਚ ਵਧੀਆ ਢੰਗ ਨਾਲ ਇਸ ਨੂੰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸਾਡੇ ਡਰੋਇੰਗ ਵਾਲੇ ਸਰ ਵੀ ਸਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਉਣ ਲੱਗ ਪਏ ਅਤੇ ਵਧੀਆ ਸਮਝਾਉਣ ਵਧੀਆ ਸਮਝਾਉਣ ਲੱਗ ਪਏ ਅਤੇ ਉਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਨੂੰ ਡਰੋਇੰਗ ਦੇ ਇੱਕ ਇੱਕ ਚੀਜ਼ ਬਾਰੇ ਦੱਸਿਆ ਅਤੇ ਮੈਨੂੰ ਹੋਰ ਵੀ ਡਰੋਇੰਗ ਵਿੱਚ ਇਨਟਰੱਸਟ ਪੈਦਾ ਹੁੰਦਾ ਗਿਆ ਤਾਂ ਮੈਂ ਹੌਲੀ ਹੌਲੀ ਮੇਰੀ ਡਰੋਇੰਗ ਵਿੱਚ ਸੁਧਾਰ ਵੀ ਆਉਂਦਾ ਗਿਆ ਅਤੇ ਮੈਂ ਹੌਲੀ ਹੌਲੀ ਮੈਨੂੰ ਔਡਰਸ ਵੀ ਕਾਫ਼ੀ ਮਿਲਦੇ ਗਏ ਡਰੋਇੰਗ ਦੇ ਅਤੇ ਮੈਂ ਲੋਕਾਂ ਲਈ ਵੀ ਡਰੋਇੰਗ ਬਣਾਉਣ ਲੱਗ ਪਈ ਇਹ ਮੇਰੇ ਕੰਮ ਦਾ ਰੁਜ਼ਗਾਰ ਵੀ ਹੋ ਗਿਆ ਅਤੇ ਮੈਂ ਪੈਸੇ ਵੀ ਕਮਾਉਣ ਲੱਗ ਪਈ ਇਸ ਚੀਜ਼ ਨਾਲ ਅਤੇ ਮੈਂ ਵਿਹਲੇ ਟਾਈਮ ਵੀ ਆਪਣੀ ਆਪਣੇ ਇਸ ਪੈਸ਼ਨ ਨੂੰ ਨਹੀਂ ਛੱਡਦੀ ਅਤੇ ਮੈਂ ਡਰੋਇੰਗ ਬਣਾ ਬਣਾਉਣਾ ਚਾਲੂ ਕਰ ਦਿੰਦੀ ਹਾਂ ਮੈਂ ਜਦੋਂ ਵੀ ਬੋਰ ਹੋ ਰਹੀ ਹੁੰਦੀ ਹਾਂ ਤਾਂ ਕਰਕੇ ਮੈਨੂੰ ਆਪਣੀ ਡਰੋਇੰਗ ਲਈ ਮੇਰੀ ਡਰੋਇੰਗ ਮੇਰੇ ਲਈ ਸਭ ਕੁਛ ਹੈ ਥੈਂਕਯੂ